ਬਾਈ ਅਗਸਤ ਉੱਨੀ ਸੌ ਨੜੇਨਵੇਂ ਕੱਤੀ ਅਕਤੂਬਰ ਦੋ ਹਜ਼ਾਰ ਬਾਰ੍ਹਾਂ ਗਿਆਰ੍ਹਾਂ ਨਵੰਬਰ ਉੱਨੀ ਸੌ ਪੈਂਠ ਇੱਕ ਜਨਵਰੀ ਦੋ ਹਜ਼ਾਰ ਵੀਹ ਪੰਦਰ੍ਹਾਂ ਸਤੰਬਰ ਦੋ ਹਜ਼ਾਰ ਤੇਈ